ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਪੁਆਧੀ ਔਰ ਮਲਵਈ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਲੇਕਿਨ ਨੌਜਵਾਨ ਆਪਣੀ ਤਰੱਕੀ ਵਾਸਤੇ ਵਿਦੇਸ਼ਾਂ ਵਿੱਚ ਜਾਣ ਵਾਸਤੇ ਆਈਲੈਟਸ ਔਰ ਵਿਦੇਸ਼ੀ ਭਾਸ਼ਾ ਫਰੈਂਚ ਭਾਸ਼ਾ ਦਾ ਸਿੱਖਣ ਦਾ ਜਰੀਆ ਲੱਭ ਰਹੇ ਹੈ ਔਰ ਸਿੱਖ ਰਹੇ ਹਨ